ਤੁਹਾਨੂੰ ਮੈਂ ਅੱਜ ਦੱਸਣਾ ਚਾਹੁੰਦਾ ਵੀ ਮੇਰੀ ਮਨਪਸੰਦ ਗੇਮ ਜਿਹੜੀ ਹੈਗੀ ਹੈ ਉਹ ਬੈਟ ਬੋਲ ਹੈ ਜਿਹੜੀ ਵੀ ਇੰਡੀਆ 'ਚ ਖੇਡੀ ਜਾਂਦੀ ਹੈ ਇਹ ਮੇਰੀ ਇਸ ਕਰਕੇ ਮਨਪਸੰਦ ਹੈਗੀ ਹੈ ਕਿਉਂਕਿ ਇਹ ਮੈਂ ਬਚਪਨ ਦੇ ਵਿੱਚ ਛੋਟੇ ਹੁੰਦਿਆਂ ਤੋਂ ਹੀ ਆਪ ਵੀ ਖੇਡਦਾ ਹੁੰਦਾ ਹੈਗਾ ਵੀ ਜਦੋਂ ਮੈਂ ਸਕੂਲ ਪੜ੍ਹਦਾ ਹਾਂ ਅਤੇ ਉਦੋਂ ਸਾਡੇ ਉੱਥੇ ਉਹ ਗਰੋਂਡ ਵੱਡੀ ਸਾਰੀ ਗਰੋਂਡ ਹੈਗੀ ਹੀ ਅਤੇ ਉਦੋਂ ਸਾਡੇ ਉੱਥੇ ਟ੍ਰੇਨਿੰਗ ਹੁੰਦਾ ਹੁੰਦਾ ਸੀ ਅਤੇ ਉਦਾਂ ਹੀ ਕਹਿੰਦੇ ਵੀ ਆਪਸ ਦੇ ਵਿੱਚ ਟੀਮ ਬਣਾ ਲਉ ਅਤੇ ਮੈਚ ਖੇਡ ਕਿਉਂਕਿ ਮੈਂ ਸ਼ੁਰੂ ਤੋਂ ਹੀ ਖੇਡਦਾ ਹੁੰਦਾ ਸਕੂਲ ਤੋਂ ਆਉਣ ਤੋਂ ਬਾਅਦ ਮੈਂ ਸ਼ਾਮ ਨੂੰ ਉੱਥੇ ਘਰ ਵੀ ਜਾਂਦਾ ਹੁੰਦਾ ਹਾਂ ਅਤੇ ਉੱਥੇ ਬਾਅਦ 'ਚੋਂ ਗਰੋਂਡ ਦੇ ਵਿੱਚ ਜਾ ਕੇ ਅਸੀਂ ਪੰਜ ਯਾਰ ਗਲੀ ਮਹੱਲੇ ਦੇ ਯਾਰ ਵੇਲੀਆਂ ਨਾਲ ਵੀ ਗੇਮ ਖੇਡਣ 'ਚ ਜਾਈ ਦੀ ਸੀ ਹਾਂਜੀ ਅਤੇ ਇਹਦੇ ਵਿੱਚ ਬਾਅਦ 'ਚੋਂ ਉਹ ਜਿਹੜੇ ਹੈਗੇ ਵੀ ਫਵਰੇਟ ਮੇਰੇ ਹੈਗੇ ਪਲੇਅਰ ਜਿਹੜੇ ਹੈਗੇ ਆ ਬੈਟਰ ਹੈਗੇ ਉਹ ਉਹ ਹੈਗਾ ਵਾ ਵਿਰਾਟ ਕੋਹਲੀ ਹੈਗਾ ਵਾ ਐੱਮ ਐੱਸ ਧੋਨੀ ਹੈਗਾ ਵਾ ਅਤੇ ਜਦੋਂ ਐੱਮ ਐੱਸੀ ਐੱਮ ਐੱਸ ਧੋਨੀ ਜਿਹੜਾ ਉਹ ਆਪਣਾ ਬੈਟ ਦਾ ਲਾਉਂਦਾ ਹੈਲੀਕੋਪਟਰ ਛੋਟ ਉਹਦਾ ਸਾਰਿਆਂ ਤੋਂ ਜ਼ਿਆਦਾ ਫੇਮਸ ਹੈਗਾ ਅਤੇ ਹਾਂਜੀ ਕ੍ਰਿਕਟ ਤਾਂ ਹੁਣ ਤੱਕ ਉਹ ਉਹ ਸਾਰੇ ਟੀ ਟਵੰਟੀ ਅਤੇ ਓ ਡੀ ਆਈ ਅਤੇ ਵਰਲਡ ਕੱਪ ਦੇ ਮੈਚ ਜਿੱਤ ਚੁੱਕੇ ਹੈਗੇ ਹੈ ਇੰਡ ਇੰਡੀਆ ਟੀਮ ਜਿਹੜੀ ਮੈਚ ਖੇਡਦੀ ਬਾਹਰਲੇ ਬਾਹਰਲੇ ਅ ਬਾਹਰਲੀ ਟੀਮ ਨਾਲ ਵੀ ਮੈਚ ਖੇਡਦੀ ਹੈਗੀ ਆ ਜਿਵੇਂ ਅਸਟ੍ਰੇਲੀਆ ਹੋ ਗਈ ਪਿੱਛ ਜੇ ਹੀ ਇਹਨਾਂ ਦਾ ਟੀ ਟਵੰਟੀ ਮੈਚ ਆਈ ਪੀ ਐੱਲ ਤੇ ਹੋਇਆ ਪੀ ਜਿਹੜੇ ਜਿੱਤ ਕਈ ਮੈਚ ਇਹਨਾਂ ਨੇ ਜਿੱਤੇ ਪਰ ਆ ਪਿੱਛੇ ਜੇ ਇੱਕ ਮੈਚ ਹੋਇਆ ਜਿਹੜਾ ਤੋਂ ਉਹ ਉਹਨਾਂ ਵਿੱਚ ਇਹਨਾਂ ਨੂੰ ਹਾਰ ਦਾ ਹਾਰ ਵੇਖਣੀ ਪਈ ਇਸ ਕਰਕੇ ਮੇਰੀ ਗੇਮ ਸਾਰਿਆਂ ਤੋਂ ਜਿਹੜੀ ਹੈਗੀ ਖੇਡ ਕਹਿ ਸਕਦੇ ਹਾਂ ਵੀ ਵਧੀਆਂ ਲੱਗਦੀ ਮੈਨੂੰ ਮਨਪਸੰਦ ਖੇਡ ਹੈ ਕਿਉਂਕਿ ਇੱਕ ਤਾਂ ਇੰਡੀਆ ਦੀ ਹੈਗੀ ਆ ਅਤੇ ਇੱਕ ਮੈਂ ਸ਼ੁਰੂ ਤੋਂ ਆਪ ਵੀ ਖੇਡਦਾ ਆਇਆ ਥੈਂਕ ਯੂ